ਹਾਂਜੀ ਅਤੇ ਮੇਲੇ ਲੱਗਦੇ ਹੈਗੇ ਆ ਉੱਦਾਂ ਕਿਨਮ ਹੈਗੇ ਆ ਬਈ ਇੱਥੇ ਇਤਿਹਾਸਿਕ ਗੁਰਦੁਆਰੇ ਵੀ ਬਹੁਤ ਹੈਗੇ ਆ ਜਿਵੇਂ ਦਾਤਣ ਸਾਹਿਬ ਹੋਇਆ ਖੂਹ ਸਾਹਿਬ ਹੋਇਆ ਟਿੱਬੀ ਸਾਹਿਬ ਹੋਇਆ ਰਕਾਬ ਸਾਹਿਬ ਟੂਟੀ ਗੰਢੀ ਸਾਹਿਬ ਸ਼ਹੀਦਾਂ ਦਾ ਗੁਰਦੁਆਰਾ ਇੱਥੇ ਹਾਂਜੀ ਅਤੇ ਇੱਥੇ ਵੀ ਕਿਨਮ ਹੈਗੇ ਬਈ ਮੇਲੇ ਵਾਧੂ ਹੂੰ ਬਈ ਵਾਧੂ ਲੱਗਦੇ ਆ ਬਈ ਲੰਗਰ ਲਗਾਉਂਦੇ ਆ ਲੋਕ ਮੇਲੇ 'ਤੇ ਤਿੰਨ ਦਿਨ ਪਹਿਲਾਂ ਬੀ ਖੰਡ ਪਾਠ ਪ੍ਰਕਾਸ਼ ਹੁੰਦੇ ਹੈਗੇ ਆ ਤੇ ਉਹ ਹਾਂਜੀ ਆ ਕਿਨਮ ਹੈਗੇ ਆ ਦਾਤਣ ਸਾਹਿਬ ਵੀ ਲੱਗਦੇ ਮਤਲਬ ਇੱਥੇ ਕਿਨਮ ਹੈਗੇ ਆ ਇੱਕ ਇੱਦਾਂ ਵੀ ਇਤਿਹਾਸ ਹੈਗਾ ਬਈ ਜਿਵੇਂ ਬਈ ਲੋਕ ਸਫਰ ਕਰਦੇ ਆ ਜਾਂ ਜਿਵੇਂ ਯਾਤਰਾ ਕਰਦੇ ਆ ਤਾਂ ਆਪਣੇ ਦਾਤਣ ਸਾਹਿਬ ਗੁਰਦੁਆਰੇ ਦਾ ਇਹ ਇਤਿਹਾਸ ਆ ਬਈ ਇੱਥੇ ਜ਼ਰੂਰ ਹੀ ਮੱਥਾ ਟੇਕਣਾ ਪੈਂਦਾ ਕਹਿੰਦੇ ਇਥੇ ਹਾਂਜੀ ਹਾਂ ਇਹ ਮਿਆ ਮਾਘੀ ਦੇ ਮੇਲੇ 'ਤੇ ਹੀ ਇੱਥੇ ਕਿਨਮ ਹੈਗੇ ਆ ਕਬਰ ਬਣੀ ਹੋਈ ਹੈਗੀ ਆ ਦਾਤਣ ਸਾਹਬ ਅਤੇ ਉੱਥੇ ਕਿਨਮ ਹੈਗੇ ਲੋਕ ਜੁੱਤੀਆਂ ਮਾਰਦੇ ਹੈ ਅਤੇ ਹਾਥੀ ਜਿਵੇਂ ਘੋੜੀਆਂ ਏ ਨਗਰ ਕੀਰਤਨ ਨਿਕਲਦਾ ਹੈਗਾ ਹੈ ਜਿਵੇਂ ਮਾਘੀ ਤੋਂ ਇੱਕ ਦਿਨ ਪਹਿਲਾਂ ਜਿਵੇਂ ਮਾਘ ਮਾਘ ਮਹੀਨੇ ਚੜ੍ਹਨ ਤੋਂ ਪਹਿਲਾਂ ਜਿਵੇਂ ਅਤੇ ਉਸ ਦਿਨ ਮ ਨਗਰ ਕੀਰਤਨ ਨਿਕਲਦਾ ਹੈਗਾ ਨਗਰ ਕੀਰਤਨ ਦੇ ਵਿੱਚ ਘੋੜੇ ਹਾਥੀ ਆਉਂਦੇ ਹੈਗੇ ਆ ਤੋ ਹਾਂਜੀ ਅਤੇ ਉੱਥੇ ਕਿਨਮ ਹੈਗੇ ਆ ਵੀ ਹਾਂ ਕਬਰ 'ਤੇ ਹਾਂ ਕਬਰ 'ਤੇ ਲੋਕ ਜੁੱਤੀਆਂ ਮਾਰਦੇ ਆ ਘੋੜਿਆਂ ਨੂੰ ਚੜਾਉਂਦੇ ਆ ਨੇਜਿਆਂ ਨਾਲ ਮਤਲਬ ਉਹਦੇ 'ਤੇ ਕਿਨਮ ਹੈਗੇ ਕਰਦੇ ਕਿਉਂਕਿ ਉਹਨੇ ਬਈ ਗੁਰੂ ਸਾਹਿਬ ਨਾਲ ਦਗ਼ਾ ਕੀਤਾ ਸੀ ਹਾਂਜੀ ਹਾਂਜੀ 'ਤੇ ਇਥੇ ਕਿਨਮ ਹੈਗੇ ਅਮ ਬਈ ਲੰਗਰ ਤਿੰਨ ਦਿਨ ਲੰਗਰ ਚਲਾਏ ਜਾਂਦੇ ਆ ਸਾਡੇ ਵੀ ਜਿਵੇਂ ਆਪਣੇ ਬਈ ਜਿਵੇਂ ਜਿਹੜੇ ਬਈ ਜਿਵੇਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਬਈ ਅਕਸਰ ਭਾਈਚਾਰਾ ਜਿਵੇਂ ਇਕੱਠੇ ਹੁੰਦੇ ਹੀ ਹਾਂ ਅਤੇ ਇੱਦਾਂ ਹੀ ਸੁਸਾਇਟੀ ਬਣੀ ਹੋਈ ਹੈ ਜਿਵੇਂ ਅਤੇ ਉਹ ਮਿਲ ਕੇ ਲੰਗਰ ਲਗਾਉਂਦੇ ਬਾਹਰੋਂ ਲੋਕ ਕਿਨਮ ਹੈਗੇ ਆ ਬਹੁਤ ਸ਼ਹਿਰਾਂ 'ਚੋਂ ਆ ਕੇ ਮਤਲਬ ਦੂਰੋਂ ਦੂਰੋਂ ਲੋਕੀ ਉੱਥੇ ਲੰਗਰ ਲਗਾਉਂਦੇ ਆ ਹਾਂਜੀ ਇਥੇ ਕਿਨਮ ਹੈਗੇ ਆ ਘੌੜ ਦੌੜ ਹੁੰਦੀ ਹੈ ਖੂਹ ਸਾਹਿਬ ਗੁਰਦੁਆਰੇ ਹਾਂਜੀ ਅਤੇ ਕਿਵ ਘੌੜ ਦੌੜ ਤਾਂ ਵੈਸੇ ਮੇਨ ਤਾਂ ਇੱਕ ਦਿਨ ਹੀ ਹੁੰਦੀ ਹੈ ਲੇਕਿਨ ਹੁਣ ਜਿਵੇਂ ਦੱਲ ਬਣੇ ਵੇ ਜਿਵੇਂ ਧਰਨਾ ਦੱਲ ਅਤੇ ਆ ਜਿਵੇਂ ਬਈ ਇੱਦਾਂ ਨਹੀਂ ਹੈਗਾ ਜੀ ਮਤਲਬ ਅਲੱਗ ਅਲੱਗ ਵੀ ਹੁਣ ਦੋ ਦਿਨ ਵੀ ਹੁੰਦੀ ਹੈ ਵੈਸੇ ਤਾਂ ਮੇਨ ਤਾਂ ਇੱਕ ਹੀ ਹੁੰਦੀ ਆ ਹਾਂਜੀ ਹਾਂ ਹਾਂ ਬਹੁਤ ਰੱਛ ਹੁੰਦਾ ਹੈ ਇੱਥੇ ਤਾਂ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਬੜੇ ਲੋਕ ਧੂਮ ਧਾਮ ਨਾਲ ਹਾਂ ਮਨਾਉਂਦੇ ਆ ਵਾਧੂ ਆਉਂਦੇ ਆ ਨਗਰ ਕੀਰਤਨ ਨਿਕਲਦਾ ਹੈਗਾ ਹੈ ਨਗਰ ਕੀਰਤਨ 'ਚ ਬਹੁਤ ਇਕੱਠ ਹੁੰਦਾ ਹੈਗਾ ਬਹੁਤ ਸੰਗਤ ਹੁੰਦੀ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਓਕੇ